ਹਾਂਜੀ ਵੈਸੇ ਤਾਂ ਮੈਂ ਕੋਈ ਵੀ ਕਲਾਸ ਨਹੀਂ ਲਗਾਈ ਵੈਸੇ ਵੀ ਮੇਰੇ ਕੋਲ ਕਈ ਕਲਰਸ ਸ਼ੋਕੀ ਦੇ ਪਏ ਹੁੰਦੇ ਸੀ ਤਾਂ ਮੈਂ ਉਹਨਾਂ ਨੂੰ ਹੀ ਯੂਜ ਕਰ ਕਰਕੇ ਮੈਂ ਕਈ ਪੇਂਟਿੰਗ ਬਣਾ ਸ ਬਣਾ ਲੈਂਦੀ ਹਾਂ ਮੈਂ ਕੋਈ ਜ ਖਤ ਵਗੈਰਾ ਵੀ ਬਣਾ ਲੈਂਦੀ ਹਾਂ ਅਤੇ ਇਸ ਦੇ ਨਾਲ ਮੈਨੂੰ ਵਧੀਆ ਲੱਗਦਾ ਹੈ ਅਤੇ ਮੈਂ ਪੇਂਟਿੰਗ ਕਰਨ ਦੇ ਨਾਲ ਕਈ ਸਟੀਚਿੰਗ ਵੀ ਕਰ ਕਰ ਸਟੀਚਿੰਗ ਦੇ ਦੌਰਾਨ ਕਈ ਨੈਕ ਦੇ ਡਿਜ਼ਾਇਨ ਵੀ ਬਣਾ ਲੈਂਦੀ ਹਾਂ ਕਈ ਡਿਜ਼ਾਇਨ ਮੈਂ ਬਣਾ ਕੇ ਉਹ ਡਰਾਇੰਗ ਦੇ ਵਿੱਚ ਰੱਖ ਲੈਂਦੀ ਹਾਂ ਤਾਂ ਜੋ ਮੈਨੂੰ ਸਟਿਚਿੰਗ ਕਰਨ ਦੇ ਦੌਰਾਨ ਮੈਨੂੰ ਸੌਖਾ ਲਾ ਸੌਖਾ ਲੱਗਦਾ ਹੋਵੇ ਅਤੇ ਫਿਰ ਮੈਂ ਉਸਦੇ ਜੋ ਡਰੈਂਗ ਬਣਾਏ ਹੁੰਦੇ ਸੀ ਅਤੇ ਉਹ ਮੈਂ ਡਿਜਾ ਡਿਜਾਇਨ ਦੇਖ ਕੇ ਮੈਨੂੰ ਉਹ ਸੂਟ 'ਤੇ ਸਟਿਚ ਨੈਕ ਡਿਜਾਇਨ ਜਾਂ ਪੋਂਚੇ ਦੇ ਡਿਜਾਇਨ ਵੀ ਮੈਨੂੰ ਬਣਾਉਣੇ ਸੌਖੇ ਲੱਗਦੇ ਸੀ ਧੰਨਵਾਦ ਜੀ